ਭਾਰਤੀ ਆਵਾਜਾਈ ਦੀ ਸੁਵਿਧਾ ਤਾਂ ਬਹੁਤ ਵਧੀਆ ਹੈ ਕਈ ਨੈਸ਼ਨਲ ਹਾਈਵੇਅ ਵੀ ਬਣੇ ਹੋਏ ਆ ਜਿਸ ਨਾਲ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਣ 'ਚ ਕਾਫ਼ੀ ਅਸਾਨੀ ਹੁੰਦੀ ਹੈ ਅਤੇ ਸਮੇਂ ਵੀ ਬੱਚਦਾ ਹੈ ਬਟ ਦਿੱਕਤ ਉਸ ਸਮੇਂ ਆਉਂਦੀ ਹੈ ਜਦੋਂ ਲੋਕ ਜੋ ਹੈ ਉਹ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਚੰਗੀ ਤਰ੍ਹਾਂ ਨਹੀਂ ਕਰਦੇ ਜਿਸ ਕਰਕੇ ਉਹ ਰੋਡ ਹਾਦਸੇ ਦੇ ਵਿੱਚ ਸ਼ਿਕਾਰ ਹੁੰਦੇ ਨੇ ਕਈ ਵਾਰ ਪ੍ਰਸ਼ਾਸਨ ਵੀ ਕੁਛ ਚੀਜ਼ਾਂ 'ਤੇ ਧਿਆਨ ਨਹੀਂ ਦਿੰਦਾ ਜਿਸ ਤਰ੍ਹਾਂ ਜਿਸ ਕਾਰਨ ਸੜਕ ਹਾਦਸੇ ਵੱਧਦੇ ਨੇ ਜਿਵੇਂ ਕਿ ਅਗਰ ਮੌਸਮ ਦੇ ਪ੍ਰਭਾਵ ਨਾਲ ਕੋਈ ਸੜਕ ਟੁੱਟੀ ਹੋਈ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਰਿਪੇਅਰ ਕਰਨਾ ਚਾਹੀਦਾ ਹੈ ਜਿਸ ਨਾਲ ਉਸ 'ਤੇ ਹਾਦਸਾ ਹੋਣ ਦਾ ਖ਼ਤਰਾ ਟਲ ਸਕੇ ਅਤੇ ਅਵਾਰਾ ਪਸ਼ੂ ਜੋ ਨੇ ਉਹ ਕਈ ਵਾਰ ਸੜਕ 'ਤੇ ਘੁੰਮਦੇ ਹੁੰਦੇ ਹਨ ਜਿਸ ਕਰਕੇ ਸੜਕ ਹਾਦਸੇ ਜ ਜੋ ਨੇ ਉਹ ਬਹੁਤ ਵੱਧਦੇ ਨੇ ਇਸ ਉੱਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹੈ ਕਿ ਉਹ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਜੋ ਕਿ ਨਿਰਧਾਰਿਤ ਇੱਕ ਸਪੀਡ ਲਿਮਟ ਹੈ ਉਹ ਸਪੀਡ ਲਿਮਟ ਦੇ ਅੰਦਰ ਰੱਖ ਕੇ ਹੀ ਆਪਣੇ ਵਾਹਨ ਚਲਾਉਣ ਇਸ ਨਾਲ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਇਹ ਕੁਛ ਚੁਣੌਤੀਆਂ ਨੇ ਜਿਨ੍ਹਾਂ ਨੂੰ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਹੈ